ਅਸੀਂ ਜਾਣਦੇ ਹਾਂ ਕਿ ਸਾਡੇ ਜਿਵੇਂ ਸਕੂਲਾਂ ਵਿੱਚ ਵੀ ਬੱਚਿਆਂ ਵਿੱਚ ਭੰਗੜੇ ਦੇ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਭੰ ਜਿਵੇਂ ਦੋ ਟੀਮਾਂ ਬਣਾ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਵਿੱਚ ਮੁਕਾ ਕੰਪਟੀਸ਼ਨ ਕਰਵਾਏ ਜਾਂਦੇ ਹਨ ਅਤੇ ਜਿਹੜੀ ਵਧੀਆ ਵਧੀਆ ਟੀਮ ਹੁੰਦੀ ਆ ਉਹਨੂੰ ਕੋਈ ਪ੍ਰਾਈਜ ਵੀ ਮਿਲਦਾ ਹੈ ਜਿਵੇਂ ਜਿਵੇਂ ਇਸ ਤਰ੍ਹਾਂ ਹੀ ਜਿਵੇਂ ਕਾਲਜ ਵਿੱਚ ਵੀ ਯੂਥ ਫੈਸਟੀਵਲ ਜਿਵੇਂ ਭੰਗੜਾ ਵੀ ਕਰਵਾਉਂਦੇ ਆ ਅਤੇ ਉਹਨਾਂ ਦਾ ਵੀ ਕੰਪੀਟੀਸ਼ਨ ਹੁੰਦਾ ਫਿਰ ਉਹਨਾਂ ਨੂੰ ਵੀ ਵਧੀਆ ਢੰਗ ਨਾਲ ਉਹ ਮਤਲਬ ਸ ਪ੍ਰਾਈਜ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਉਸ ਨਾਲ ਉਹਨਾਂ ਦਾ ਹੌਸਲਾ ਵੱਧਦਾ ਅਤੇ ਫਿਰ ਨੈਸ਼ਨਲ ਲੈਵਲ 'ਤੇ ਵੀ ਕਈ ਤਰ੍ਹਾਂ ਕਈ ਥਾਵਾਂ 'ਤੇ ਇਹ ਫੈਸ ਇਹ ਭੰਗੜਾ ਕੰਪਟੀਸ਼ਨ ਕਰਵਾਏ ਜਾਂਦੇ ਹੈ ਅਤੇ ਜਿਸ ਵਿੱਚ ਵੀ ਵੱਧ ਚੜ੍ਹਕੇ ਸਾਰੇ ਹੀ ਭਾਗ ਲੈਂਦੇ ਹਨ ਜਿਵੇਂ ਉਹਨਾਂ ਦਾ ਜਿਵੇਂ ਉਹ ਵਧੀਆ ਪਰਫੋਰਮੈਂਸ ਕਰਦੇ ਹੈ ਅਤੇ ਉਹਨਾਂ ਨੂੰ ਜਦੋਂ ਕਿਸੇ ਟੀਮ ਦਾ ਜ਼ਿਆਦਾ ਹੁੰਦਾ ਹੈਗਾ ਪਰਫੋਰਮੈਂਸ ਵਧੀਆ ਹੁੰਦੀ ਆ ਉਹਨਾਂ ਨੂੰ ਪ੍ਰਾਈਜ ਦਿੱਤਾ ਜਾਂਦਾ ਅਤੇ ਮਤਲਬ ਉਹਨਾਂ ਦੀ ਹੌਸਲਾ ਅਫਜਾਈ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਤਰ੍ਹਾਂ ਇੰਟਰਨੈਸ਼ਨਲ ਲੈਵਲ 'ਤੇ ਵੀ ਮਤਲਬ ਕਰਵਾਏ ਜਾਂਦੇ ਹੈ ਮੁਕਾਬਲੇ ਭੰਗੜੇ ਦੇ ਮੁਕਾਬਲੇ ਕਰਵਾਏ ਜਾਂਦੇ ਆ ਜਿਸ ਤਰ੍ਹਾਂ ਉਹਨਾਂ ਦਾ ਮਤਲਬ ਉਹਨਾਂ ਨੂੰ ਵੀ ਹੌਸਲਾ ਇਹ ਸਾਰੇ ਜਿਹੜੇ ਕੰਪਟੀਸ਼ਨ ਕਰਵਾਏ ਜਾਂਦੇ ਹਨ ਉਹਨਾਂ ਵਿੱਚ ਸਭ ਸਭ ਬ ਬੱਚਿਆਂ ਦੀ ਵੱਡਿਆਂ ਦੀ ਹੌਸਲਾ ਅਫਜਾਈ ਵੱਧਦੀ ਹੈ ਜਿਸ ਤਰ੍ਹਾਂ ਕਿ ਜਿਵੇਂ ਕਿਸੇ ਟੀਮ ਨੇ ਵੱਧ ਮਤਲਬ ਵਧੀਆ ਪਰਫੋਰਮੈਂਸ ਕੀਤੀ ਆ ਉਹਨਾਂ ਨੂੰ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਇਸ ਨਾਲ ਵੀ ਸਾਡਾ ਇਹ ਕੰਪਟੀਸ਼ਨ ਚੱਲਦੇ ਰਹਿੰਦੇ ਹਨ ਅਤੇ ਇਹ ਮੁਕਾਬਲੇ ਇਸ ਤਰ੍ਹਾਂ ਹੀ ਹੁੰਦੇ ਰਹਿੰਦੇ ਹਨ